ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਮੈਂ ਮਾਨਸਾ ਤੋਂ ਗੱਲ ਕਰ ਰਿਹਾ ਹਾਂ ਮੈਂ ਦੋ ਦਿਨ ਪਹਿਲਾਂ ਤੁਹਾਡੀ ਸਾਈਟ ਤੋਂ ਪੱਖਾ ਆਰਡਰ ਕੀਤਾ ਸੀ ਜਿਸ ਦਾ ਆਰਡਰ ਨੰਬਰ ਤੁਹਾਨੂੰ ਈਮੇਲ ਕਰ ਦਿੱਤਾ ਹੈ ਇਸ ਆਰਡਰ ਨੂੰ ਮੈਂ ਰੱਦ ਕਰ ਦਿੱਤਾ ਸੀ ਇਸਦੇ ਪੈਸੇ ਮੈਨੂੰ ਵਾਪਿਸ ਨਹੀਂ ਮਿਲੇ ਕਿਰਪਾ ਕਰਕੇ ਜਲਦੀ ਪੈਸੇ ਵਾਪਿਸ ਕੀਤੇ ਜਾਣ ਧੰਨਵਾਦ ਬਹੁਤ ਬਹੁਤ ਧੰਨਵਾਦ